ਬੈਂਕ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਸਭ ਨਾਲੋਂ ਪਹਿਲਾਂ ਤਾਂ ਸਾਨੂੰ ਉਸ ਦੀ ਜ਼ਰੂਰੀ ਸ਼ਿਕਸ਼ਾ ਹੋਣੀ ਬਹੁਤ ਜ਼ਰੂਰੀ ਹੈ ਫਿਰ ਉਸ ਤੋਂ ਬਾਅਦ ਹਰ ਇੱਕ ਰਾਜ ਦੇਸ਼ ਵਿੱਚ ਬੈਂਕ 'ਚ ਨੌਕਰੀ ਪ੍ਰਾਪਤ ਕਰਨ ਲਈ ਇੱਕ ਟੈਸਟ ਦੇਣਾ ਪੈਂਦਾ ਹੈ ਜਿਸ ਵਿੱਚ ਉਸ ਦੀ ਉਪਯੋਗਤਾ ਸਾਬਿਤ ਕਰਨੀ ਪੈਂਦੀ ਹੈ ਟੈਸਟ ਪਾਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਬੈਂਕ ਹੈ ਹਰ ਇੱਕ ਜਿਹੜੀ ਜਿਹੜੀ ਵਿਦਿਆਰਥੀ ਜਾਂ ਕਹਿ ਸਕਦੇ ਹੋ ਲੋਕ ਪਾਸ ਹੋਏ ਹਨ ਉਹਨਾਂ ਦੀ ਇੰਟਰਵਿਊ ਬੁਲਾਉਂਦਾ ਹੈ ਇੰਟਰਵਿਊ ਵਿੱਚ ਵੀ ਉਹਨਾਂ ਨੂੰ ਕਈ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਹਨ ਫਿਰ ਉਹਨਾਂ ਉਹਨਾਂ ਲੋਕਾਂ ਵਿੱਚੋਂ ਬੰਦੇ ਸ਼ੌਟਲਿਸਟ ਕੀਤੇ ਜਾਂਦੇ ਹਨ ਅਤੇ ਉਹਨਾਂ ਨੂੰ ਸਲੈਕਟ ਕੀਤਾ ਜਾਂਦਾ ਹੈ ਮੇਰੀ ਵੱਡੀ ਭੈਣ ਨੇ ਬੈਂਕਿੰਗ ਦੀ ਨੌਕਰੀ ਦੀ ਅਰਜ਼ੀ ਦਿੱਤੀ ਸੀ ਉਹਨੂੰ ਉਸ ਨੂੰ ਨੌਕਰੀ ਵੀ ਪ੍ਰਾਪਤ ਹੋ ਗਈ ਅੱਜ ਉਹ ਮੈਨੇਜਰ ਦੀ ਪੋਸਟ 'ਤੇ ਹੈ ਉਸ ਨੂੰ ਬੈਂਕ ਵਿੱਚ ਕੰਮ ਕਰਨ ਦੀ ਬਹੁਤ ਸਾਰੇ ਫਾਇਦੇ ਮਿਲਦੇ ਸਭ ਤੋਂ ਪਹਿਲਾਂ ਤਾਂ ਉਸ ਨੂੰ ਇੱਕ ਵਧੀਆ ਨੌਕਰੀ ਮਿਲੀ ਹੈ ਜੋ ਕਿ ਇੱਜਤਦਾਰ ਨੌਕਰੀ ਹੈ ਅਤੇ ਉਸਨੂੰ ਬਹੁਤ ਹੀ ਚੰਗੀ ਤਨਖਾਹ ਮਿਲਦੀ ਹੈ ਉਸਨੂੰ ਬੈਂਕ 'ਚ ਕੰਮ ਕਰਨ ਦੇ ਬਹੁਤ ਸਾਰੇ ਫਾਇਦੇ ਮਿਲਦੇ ਹਨ ਕਈ ਤਰ੍ਹਾਂ ਦੇ ਲੋਨ ਉਹਨੂੰ ਸਸਤੇ ਰੇਟ 'ਤੇ ਮਿਲਦੇ ਹਨ ਅਤੇ ਉਹਨੂੰ ਕਈ ਤਰ੍ਹਾਂ ਦੀ ਸਰਕਾਰੀ ਸੁਵਿਧਾਵਾਂ ਵੀ ਉਪਲਬਧ ਹਨ ਬੈਂਕ ਉਸ ਨੂੰ ਕਈ ਤਰ੍ਹਾਂ ਦੇ ਮੁਨਾਫੇ ਵੀ ਦਿੰਦਾ ਹੈ ਜਿੰਨੇ ਘੰਟੇ ਉਹ ਜ਼ਿਆਦਾ ਕੰਮ ਕਰਦੀ ਹੈ ਉਸ ਨੂੰ ਉਹਨੇ ਘੰਟੇ ਜ਼ਿਆਦਾ ਤਨਖਾਹ ਮਿਲਦੀ ਹੈ ਧੰਨਵਾਦ